ਹੈਲੋ ਵਧੀਆ ਵਧੀਆ ਜੀ ਕੌਣ ਜੀ ਓਕੇ ਓਕੇ ਜੀ ਓਕੇ ਜੀ ਹਾਂਜੀ ਹਾਂਜੀ ਓਕੇ ਜੀ ਓਕੇ

ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਮੈਂ ਤੁਸੀਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਤੁਸੀਂ ਕਿੱਦਾਂ ਦਾ ਘਰ ਲੈਣਾ ਚਾਹੁੰਦੇ ਹੋ ਜੀ ਮੰਨ ਲਓ ਇੱਕ ਤਾਂ ਓਕੇ ਓਕੇ ਜੀ ਓਕੇ ਓਕੇ ਓਕੇ ਜੀ ਓਕੇ ਦੇਖਿਓ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਇੱਕ ਤਾਂ ਮਕਾਨ ਜੋ ਹੈਗਾ ਆਪਣੇ ਕੋਲ ਉਹ ਇੱਕ ਤਾਂ ਐਂ ਮੰਨ ਲਓ ਸਿਟੀ 'ਚ ਨੇ ਆਪਣੇ ਸ਼ਹਿਰ ਵਿੱਚ ਨੇ ਇੱਕ ਆਪਣੇ ਕੋਲ ਲੇ ਜਾਣੀ ਕਿ ਪਿੰਡ ਵਿੱਚ ਆਪਣੇ ਕੋਲ ਹੈਗੇ ਨੇ ਤੁਸੀਂ ਕਿੱਥੇ ਲੈਣਾ ਚਾਹੁੰਦੇ ਜੀ ਪਿੰਡ ਵਿੱਚ ਮੰਨ ਲਓ ਅਸਪੈਕਟ ਕਰਦੇ ਹੋ ਜਾਂ ਮੰਨ ਲਓ ਸ਼ਹਿਰ ਵਿੱਚ ਕਰਦੇ ਹੋ ਜੀ ਓਕੇ ਓਕੇ ਜੀ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਤੁਸੀਂ ਮੰਨ ਲਓ ਘਰ 'ਤੇ ਕਿੰਨੇ ਕੁ ਰੁਪਈਏ ਜਿਹੜੇ ਹੈਗੇ ਲਗਾਉਣੇ ਚਾਹੁੰਦੇ ਹੋ ਜੀ ਕਿੰਨਾ ਕੁ ਤੁਹਾਨੂੰ ਮੰਨ ਲਓ ਹੈਗਾ ਚਾਲ੍ਹੀ ਤੱਕ ਜੀ ਓਕੇ ਜੀ ਤੁਸੀਂ ਕਿੰਨੇ ਕੁ ਦਿੱਤੇ ਮੰਨ ਲਓ ਮ ਜਿਹੜਾ ਹੈਗਾ ਸਕੇਅਰ ਫੁੱਟ 'ਚ ਘਰ ਤੁਸੀਂ ਲੈਣਾ ਚਾਹੁੰਦੇ ਹੋ ਜੀ ਪੰਜਾਹ ਚਾਲ੍ਹੀ ਦਾ ਓਕੇ ਜੀ ਓਕੇ ਦੇਖੋ ਇੱਕ ਤਾਂ ਆਪਣੇ ਕੋਲ ਸਾਇਡ 'ਤੇ ਮਕਾਨ ਬਹੁਤ ਪਏ ਨੇ ਜੀ ਇੱਕ ਤਾਂ ਮੰਨ ਲਓ ਕਲੋਨੀ ਦੇ ਵਿੱਚ ਆਪਣੇ ਕੋਲ ਜਗ੍ਹਾ ਪਈ ਇੱਕ ਪਾਸੇ ਜਿੱਥੇ ਮੰਨ ਲਓ ਸ਼ਹਿਰ 'ਚ ਕਲੋਨੀਆਂ ਹੁੰਦੀਆਂ ਨਾ ਜੀ ਸ਼ਹਿਰ 'ਚ ਕਲੋਨੀ ਵਿੱਚ ਤੁਹਾਨੂੰ ਜਗ੍ਹਾ ਮਿਲ ਸਕਦੀ ਹੈ ਜਾਂ ਤੁਸੀਂ ਮੰਨ ਲਓ ਇੱਕ ਤਰ੍ਹਾਂ ਦਾ ਆਪਾਂ ਕਹਿ ਦਈਏ ਵੀ ਜਮ੍ਹਾਂ ਬਾਜ਼ਾਰ ਦੇ ਵਿੱਚ ਜਿੱਥੇ ਆਪਾਂ ਸ਼ੋਪ ਹੁੰਦੀਆਂ ਨੇ ਸੋਪਸ ਉਹ 'ਚ ਵੀ ਆਪਣੇ ਕੋਲ ਜਗ੍ਹਾ ਪਈ ਹੈ ਤੁਸੀਂ ਦੱਸੋ ਜੀ ਤੁਸੀਂ ਆਪਣੀ ਹੈਗੀ ਹੈ ਜਿਹੜੀ ਕਲੋਨੀ 'ਚ ਜੀ ਓਕੇ ਓਕੇ ਜੀ ਓਕੇ ਜੀ ਉਹ ਕਲੋਨੀ 'ਚ ਵੀ ਦੇਖੋ ਜੀ ਦੋ ਟਾਈਪਸ ਦੇ ਘਰ ਨੇ ਕਲੋਨੀ 'ਚ ਇੱਕ ਪਾਸੇ ਦੇਖੋ ਜੀ ਇੱਕ ਪਾਸੇ ਦਾ ਜਿਹੜੀਆਂ ਹੈਗੀਆ ਨੇ ਆਪਣੇ ਕੋਲ ਵੱਡੀ ਸਿਟੀਜਨ ਮਤਲਬ ਕਿ ਮੰਨ ਲਓ ਗੌਰਮੈਂਟ ਜੋਬ 'ਤੇ ਲੱਗੇ ਹੋਏ ਨੇ ਉਹ ਸਾਰੇ ਮੰਨ ਲਓ ਇੱਕ ਸਾਈਡ 'ਤੇ ਉਹਨਾਂ ਦੇ ਸਾਰਿਆਂ ਦੇ ਮਕਾਨ ਉਹਨਾਂ ਦੇ ਘਰ ਨੇ ਇੱਕ ਪਾਸੇ ਜੀ ਇੱਕ ਪਾਸੇ ਆਮ ਜਨਰਲ ਜਿਹੜੇ ਹੈਗੇ ਨੇ ਵਰਕ ਆਪਾਂ ਕਹਿ ਦਈਏ ਉਹਨਾਂ ਦੇ ਘਰ ਹੈਗੇ ਨੇ ਜੀ ਤੁਸੀਂ ਕਿਹਨਾਂ ਕੋਲ ਆਪਣਾ ਜਿਹੜਾ ਘਰ ਲੈਣਾ ਚਾਹੁੰਦੇ ਹੋ ਜੀ ਓਕੇ ਓਕੇ ਜੀ ਤੁਸੀਂ ਇੱਦਾਂ ਕਰਿਓ ਜੀ ਮੈਂ ਤੁਹਾਨੂੰ ਥੋੜ੍ਹਾ ਮੋਟਾ ਹੈਗਾ ਨਾ ਜਿਹੜਾ ਜੀ ਥਾਂ ਤੁਹਾਨੂੰ ਪਰਵਾਨ ਕਰੂੰਗਾ ਹਾਂਜੀ ਜਿਵੇਂ ਤੁਸੀਂ ਇੱਦਾਂ ਕਰੋ ਜੀ ਮੈਂ ਤੁਹਾਡੇ ਵਾਸਤੇ ਮਕਾਨ ਦੋ ਤਿੰਨ ਦੇਖ ਰੱਖੇ ਨੇ ਜੀ ਤੁਸੀਂ ਮੇਰੇ ਅੋਫਿਸ 'ਚ ਆਇਓ ਉੱਥੇ ਆਪਾਂ ਬਹਿ ਕੇ ਗੱਲ ਕਰਾਂਗੇ ਜੀ ਹਾਂਜੀ ਹਾਂਜੀ ਤੁਸੀਂ ਇੱਦਾਂ ਕਰਿਓ ਜੀ ਮੈਨੂੰ ਤੁਸੀਂ ਕੱਲ੍ਹ ਆ ਕੇ ਮਿਲ ਸਕਦੇ ਹੋ ਜੀ ਹਾਂਜੀ ਤੁਸੀਂ ਇੱਦਾਂ ਕਰਿਓ ਕੱਲ੍ਹ ਨੂੰ ਮੈਨੂੰ ਨੌ ਵਜੇ ਆ ਕੇ ਮੇਰੇ ਅੋਫਿਸ ਗੱਲ ਕਰ ਲਿਓ ਠੀਕ ਆ ਜੀ ਓਕੇ ਓਕੇ ਥੈਂਕ ਯੂ ਜੀ ਓਕੇ ਓਕੇ ਜੀ